ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਬਲਕਾਰ ਸਿੰਘ ਬਠਿੰਡਾ ਸੈਂਟਰਨ ਯੂਨੀਵਰਸਿਟੀ ਤੋਂ ਬੋਲ ਰਿਹਾ ਹਾਂ ਮੈਂ ਆਪਣੇ ਜਨਮਦਿਨ 'ਤੇ ਅੱਜ ਦਸ ਬਰਗਰ ਪੰਜ ਪੀਜੇ ਅਤੇ ਤਿੰਨ ਕੋਲਡ ਡਰਿੰਕ ਦੀਆਂ ਬੋਤਲਾਂ ਔਡਰ ਕੀਤੀਆਂ ਸਨ ਪਰ ਅੱਜ ਅਚਾਨਕ ਮਹਿਮਾਨ ਨਹੀਂ ਆਏ ਕਿਉਂਕਿ ਅੱਜ ਗਰਮੀ ਜ਼ਿਆਦਾ ਸੀ ਇਸ ਕਰਕੇ ਬੱਸਾਂ ਦੇ ਵਿੱਚ ਸਫਰ ਕਰਨਾ ਔਖਾ ਸੀ ਮੈਂ ਅੰਦਾਜ਼ਾ ਲਗਾਇਆ ਸੀ ਕਿ ਮੇਰੇ ਜਨਮਦਿਨ 'ਤੇ ਘੱਟੋ ਘੱਟ ਦਸ ਸ ਵਿਦਿਆਰਥੀ ਪਹੁੰਚ ਜਾਣਗੇ ਪਰ ਉਹਨਾਂ ਦਸਾਂ ਵਿਦਿਆਰਥੀਆਂ ਵਿੱਚੋਂ ਸਿਰਫ ਅੱਜ ਪੰਜ ਵਿਦਿਆਰਥੀ ਹੀ ਪਹੁੰਚ ਸਕੇ ਇਸ ਲਈ ਮੈਨੂੰ ਇਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਵਾਧੂ ਜਾਪਦੀਆਂ ਜੋ ਕਿ ਮੈਂ ਹਟਾਉਣਾ ਚਾਹੁੰਦਾ ਹਾਂ ਸੋ ਕਿਰਪਾ ਕਰਕੇ ਮੇਰੇ ਇਹਨਾਂ ਆਈਟਮਾਂ ਵਿੱਚੋਂ ਕੋਲਡ ਡਰਿੰਕ ਦੀ ਇੱਕ ਬੋਤਲ ਪੀਜੇ ਵਿੱਚੋਂ ਦੋ ਪੀਜੇ ਦੀਆਂ ਆਈਟਮਾਂ ਅਤੇ ਬਰਗਰ ਵਿੱਚੋਂ ਚਾਰ ਬਰਗਰ ਘਟਾ ਦਿੱਤੇ ਜਾਣ ਤਾਂ ਜੋ ਮੈਂ ਆਪਣਾ ਬ ਔਡਰ ਉਹ ਪੂਰੀ ਤਰੀਕੇ ਨਾਲ ਪੂਰਾ ਕਰ ਸਕਾਂ ਅਤੇ ਆਪਣਾ ਜਨਮਦਿਨ ਮਨਾ ਸਕਾਂ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ